ਵਧੀਆ ਡਰਾਇੰਗ ਕਰਨ ਲਈ ਅਤੇ ਵੱਡੇ ਪੱਧਰ 'ਤੇ ਪਹੁੰਚਣ ਦੀ ਸਾਨੂੰ ਛੋਟੀ ਤੋਂ ਛੋਟੀ ਡਰੋਇੰਗ ਤੋਂ ਪਹਿਲਾਂ ਆਪਣੀ ਕਲਾਕਾਰੀਆਂ ਦਿਖਾ ਕੇ ਸ਼ੁਰੂ ਕਰਨਾ ਚਾਹੀਦਾ ਹੈ ਸਾਰਿਆ ਨਾਲੋਂ ਪਹਿਲਾਂ ਜਦੋਂ ਆਪਾਂ ਕੋਈ ਵੀ ਡਰੋਇੰਗ ਦੀ ਕਲਾਸ 'ਤੇ ਜਾਂਦੇ ਹਾਂ ਤਾਂ ਸਾਨੂੰ ਪਹਿਲਾਂ ਜਿਹੜੇ ਕਲਰਜ ਹੁੰਦੇ ਨੇ ਉਹ ਚਲਾਉਣੇ ਸਿਖਾਉਂਦੇ ਨੇ ਸ਼ੇਡਿੰਗ ਕਰਨੀ ਸਿਖਾਉਂਦੇ ਨੇ ਸਾਰਿਆ ਨਾਲੋਂ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਸ਼ੇਡਿੰਗ ਕਰਨੀ ਆਉਣੀ ਚਾਹੀਦੀ ਆ ਤੋਂ ਪਹਿਲਾਂ ਸ਼ੇਡਿੰਗ ਤੋਂ ਹੀ ਸਾਰਾ ਕੰਮ ਸ਼ੁਰੂ ਕਰਦੇ ਨੇ ਜਿਵੇਂ ਸੇਬ ਦੇ ਦਿੱਤਾ ਕੋਈ ਕਾਪੀ ਕਿਤਾਬ ਤੁਹਾਡੇ ਸਾਹਮਣੇ ਰੱਖ ਦਿੱਤੀ ਵੀ ਇਹਨੂੰ ਸ਼ੇਡਿੰਗ ਕਰਕੇ ਦਿਖਾਓ ਇਹਦੀ ਥਰੀ ਡੀ ਫੋਰ ਦੀ ਟੂ ਡੀ ਸ਼ੇਡਿੰਗ ਬਣਾਓ ਠੀਕ ਹੈ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਇੱਕ ਸਾਹਮਣੇ ਬੰਦਾ ਬਿਠਾ ਦਿੰਦੇ ਹਨ ਅਗਰ ਕੋਈ ਵੱਡੀ ਡਰਾ ਤੁਸੀਂ ਡਰਾਇੰਗ ਬਣਾਉਣੀ ਹੈ ਸਾਹਮਣੇ ਬੰਦਾ ਬਿਠਾ ਕੇ ਉਹਨੂੰ ਆਪਣੀ ਡਰੋਇੰਗ 'ਤੇ ਉਤਾਰਨਾ ਹੈ ਤਾਂ ਡੀਟੇਲਿੰਗ ਦੇ ਵਿੱਚ ਤੁਹਾਨੂੰ ਪਹਿਲਾਂ ਪੋਰਟਰੇਟ ਬਣਾਉਣੇ ਸਿੱਖਣੇ ਪੈਣਗੇ ਪੋਰਟਰੇਟ ਦੇ ਵਿੱਚ ਤੁਸੀਂ ਅੱਖਾਂ ਦਾ ਨਾਪ ਨੱਕ ਦਾ ਨਾਪ ਬੁੱਲਾ ਦਾ ਨਾਪ ਤੁਹਾਨੂੰ ਉਹ ਪਰੋਪਰ ਪੈਨਸਿਲ ਦੇ ਨਾਲ ਹੀ ਲੈ ਕੇ ਸਿਖਾਇਆ ਜਾਂਦਾ ਹੈ ਕਿ ਦੂਰੋ ਦੀ ਕਿਵੇਂ ਦੇਖ ਕੇ ਉਸਨੂੰ ਆਪਣੀ ਕਲਮ ਦੇ ਨਾਲ ਆਪਣੀ ਡਰੋਇੰਗ 'ਤੇ ਉਤਾਰਨਾ ਹੈ ਤਾਂ ਤੁਸੀਂ ਉਹ ਚੀਜ਼ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖ ਸਕਦੇ ਹੋ ਪਰ ਇਹ ਬਹੁਤ ਹੀ ਹੌਲੀ ਹੌਲੀ ਕਰਨਾ ਪੈਂਦਾ ਹੈ ਹੌਲੀ ਛੋਟੀ ਤੋਂ ਲੈ ਕੇ ਵੱਡੀ ਤੱਕ ਆਪਾਂ ਨੂੰ ਇਹ ਚੀਜ਼ਾਂ ਸਿੱਖਣੀਆਂ ਪੈਂਦੀਆਂ ਮੈਂ ਕਈ ਡਰੋਂਗਾਂ ਡਰਾਇੰਗਾਂ ਬਣਾਈਆਂ ਹਨ ਮੇਰੀਆਂ ਕਈ ਵਧੀਆ ਵਧੀਆ ਜਿਹੜੀਆਂ ਡਰੋਇੰਗਾਂ ਨੇ ਉਹਨਾਂ ਨੂੰ ਮੈਂ ਸੇਲ ਵੀ ਕੀਤਾ ਹੈ ਵਧੀਆ ਪੈਸੇ ਵੀ ਮਿਲੇ ਆ ਉਸ ਦੇ ਮੈਨੂੰ